ਹਾਂਜੀ ਤਲਵਿੰਦਰ ਸਿੰਘ ਜੀ ਕੀ ਹਾਲ ਚਾਲ ਹੈ ਬਰਦਰ ਵਧੀਆ ਮਲਕੀਤ ਸਿੰਘ ਬੋਲਦਾ ਬਾਈ ਜੀ ਹੋਰ ਵੀਰ ਜੀ ਠੀਕ ਠਾਕ ਹੋ ਨੰਬਰ ਸੇਵ ਨਹੀਂ ਸੀਗਾ ਓਕੇ ਓਕੇ ਚਲੋ ਇੱਦਾਂ ਮੈਂ ਤਾਂ ਨਾ ਇੱਕ ਬੇਨਤੀ ਸੀਗੀ ਵੀ ਆਪਣੇ ਜ਼ਿਲ੍ਹੇ ਮਾਨਸਾ ਦਾ ਸਭ ਤੋਂ ਬੈਸਟ ਸਕੂਲ ਮਤਲਬ ਕਿਹੜਾ ਹੈ ਬ੍ਰਦਰ ਜਿਹੜੇ ਮਤਲਬ ਪ੍ਰਾਈਵੇਟ ਸਕੂਲ ਨੇ ਗੇ ਨਹੀਂ ਉਹ ਤਾਂ ਠੀਕ ਹੈ ਵੀ ਆਮ ਜਿਹੜਾ ਪਤਾ ਕੀ ਗੱਲ ਹੈ ਜਿਹੜਾ ਕੋਈ ਬੰਦਾ ਵਿਚਾਰਾ ਕੋਈ ਦਿਹਾੜੀ ਤੱਪੇ ਵਾਲਾ ਜਿਹੜਾ ਮਤਲਬ ਕੋਈ ਮਤਲਬ ਥੋੜ੍ਹਾ ਜਿਹਾ ਵਿਚਾਰਾ ਮਿਡਲ ਕਲਾਸ ਲਾ ਲਓ ਜਿਹੜੇ ਉਹ ਤਾਂ ਫਿਰ ਬੱਚੇ ਨੂੰ ਕਿੱਥੇ ਉੱਥੇ ਪੜ੍ਹਾਊਗਾ ਹੈ ਨਾ ਪਹਿਲਾ ਹੀ ਮੈਂ ਤਾਂ ਕਹਿੰਦਾ ਜਿਹੜੇ ਅੱਜ ਕੱਲ੍ਹ ਸਮਾਰਟ ਸਕੂਲ ਬਣ ਗਏ ਵੀ ਜਿਹੜੇ ਸਰਕਾਰੀ ਸਕੂਲ ਨੇ ਇਹੀ ਮੇਰੇ ਹਿਸਾਬ ਨਾਲ ਬੈਸਟ ਨੇ ਬੱਚਿਆਂ ਨੂੰ ਤਲੀਮ ਵਧੀਆ ਸਰ ਚਲੋ ਟੀਚਰ ਵੀ ਪੂ ਅੱਛੇ ਨੇ ਬਾਕੀ ਮਤਲਬ ਜਿਹੜੀ ਬੱਚਿਆਂ ਦਾ ਜਿਹੜਾ ਇਹ ਹੈ ਵੀ ਚਲੋ ਕਈ ਮਤਲਬ ਸਵੇਰੇ ਬੱਚੇ ਨਹੀਂ ਬਰੇਕਫਾਸਟ ਕਰਕੇ ਆਉਂਦੇ ਉਹਨਾਂ ਲਈ ਜਿਹੜਾ ਮਿਡਡੇ ਮੀਲ ਵਗੈਰਾ ਦਾ ਜਿਹੜਾ ਹੈਗਾ ਇਹ ਸਰਕਾਰ ਨੇ ਹਰ ਵਧੀਆ ਅੱਛੇ ਉਪਰਾਲੇ ਕੀਤੇ ਹੋਏ ਨੇ ਹੈ ਨਾ ਜੀ ਜੀ ਨਹੀਂ ਇਹ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਨਾ ਮ ਆਪਣਾ ਕੀ ਹੈ ਨਾ ਜੀ ਇਹ ਸ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਅੱਛਾ ਮਤਲਬ ਚੱਲ ਰਿਹਾ ਇਹ ਤਾਂ ਖੈਰ ਮਿਡਡੇ ਮੀਲ ਤਾਂ ਵਧੀਆ ਅੱਛਾ ਮਤਲਬ ਰਿਸਪੋਂਸ ਹੈ ਇਹਨਾਂ ਦਾ ਉਹ ਵੀ ਹ ਮਤਲਬ ਹਾਂ ਜੀ ਇੱਕ ਤਾਂ ਖੁੱਲ੍ਹੇ ਗਰਾਊਂਡ ਵਗੈਰਾ ਹੈਗੇ ਨੇ ਬੱਚਿਆਂ ਨੂੰ ਕੋਈ ਐਕਟੀਵਿਟੀ ਕਰਨੀ ਹੈ ਜਾਂ ਬੱਚਿਆਂ ਨੇ ਕੋਈ ਗੇਮ ਦੇ ਵਿੱਚ ਮਤਲਬ ਗੇਮ ਨਾਲ ਵਧੀਆ ਮਤਲਬ ਚਲੋ ਬੱਚੇ ਦਾ ਵਿਕਾਸ ਵਧੀਆ ਹੁੰਦਾ ਹੈ ਨਾ ਹਾਂ ਕਿਉਂ ਮਤਲਬ ਇਹ ਵੀ ਬੱਚੇ ਘੁੰਮ ਫਿਰ ਕੇ ਅਤੇ ਜਿਹੜਾ ਮਿਡਡੇ ਮੀਲ ਆ ਚਲੋ ਬੱਚੇ ਨੇ ਵੀ ਮਤਲਬ ਨਾਲੇ ਤਾਂ ਬੱਚੇ ਦਾ ਪੇਟ ਵਗੈਰਾ ਹੋ ਜਾਂਦਾ ਦੂਜਾ ਜਿਹੜੇ ਮਤਲਬ ਖੇਡਾਂ ਵਗੈਰਾ ਦੇ ਵਿੱਚ ਜਿਹੜੇ ਬੱਚੇ ਮਤਲਬ ਅੱਛੇ ਨਿਕਲ ਰਹੇ ਨੇ ਅੱਜ ਕੱਲ੍ਹ ਸਰਕਾਰੀ ਸਕੂਲਾਂ ਦੇ ਬੱਚੇ ਮੇਰੇ ਹਿਸਾਬ ਨਾਲ ਬੈਸਟ ਨੇ ਹੈ ਨਾ ਕੰਪੀਟੀਸ਼ਨ ਦੇ ਵਿੱਚ ਆਮ ਕਈ ਵਾਰੀ ਕੰਪੀਟੀਸ਼ਨ ਆ ਬੱਚੇ ਮਤਲਬ ਸਕੂਲਾਂ ਦੇ ਵਿੱਚੋਂ ਮੈਂ ਦੇਖਿਆ ਵਧੀਆ ਜਿਵੇਂ ਹੁਣ ਗਵਰਮੈਂਟ ਜੋਬ ਦੇ ਵਿੱਚ ਵਧੀਆ ਸਰਕਾਰੀ ਸਕੂਲਾਂ ਦੇ ਵਿੱਚੋਂ ਬੱਚੇ ਵਧੀਆ ਆਈ ਐਸ ਵੀ ਇੱਧਰੋਂ ਮਤਲਬ ਬੱਚੇ ਜਾ ਰਹੇ ਨੇ ਅਤੇ ਕੁਛ ਮਤਲਬ ਜਿਹੜੀ ਪਤਾ ਕੀ ਕਹਿੰਦਾ ਥੋੜ੍ਹਾ ਜਿਹਾ ਹੋਰ ਮਤਲਬ ਸੁਧਾਰ ਹੋਣਾ ਚਾਹੀਦਾ ਜਿਵੇਂ ਹੁਣ ਬੱਚੇ ਆਈਲੈਟਸ ਕਰਕੇ ਜਿਹੜੇ ਹਿਸਾਬ ਨਾਲ ਬਾਹਰ ਜਾ ਰਹੇ ਨੇ ਉਹ ਹੁਣ ਥੋੜ੍ਹਾ ਜਿਹਾ ਅੱਗੇ ਨਾਲੋਂ ਮਤਲਬ ਧੀਮੀ ਗੱਡੀ ਨਾਲ ਹੋ ਰਿਹਾ ਕੰਮ ਜਿਹੜੇ ਅੱਗੇ ਮਤਲਬ ਬੱਚੇ ਅੱਗੇ ਜ਼ਿਆਦਾ ਮਤਲਬ ਹਰ ਇੱਕ ਜਿਹੜਾ ਸਟੈਂਡਰਡ ਸੀਗਾ ਖੇਤਰ ਸੀਗਾ ਜਿਹੜੇ ਆ ਤੁਹਾਡੇ ਆਈਲਟਸ ਸਕੇਅਰ ਸੈਂਟਰ ਸੀਗੇ ਉਹਨਾਂ ਦੇ ਉੱਪਰ ਬੜੀ ਦੇਖਣ ਨੂੰ ਭੀੜ ਮਿਲਦੀ ਸੀ ਪਰ ਹੁਣ ਥੋੜ੍ਹਾ ਜਿਹਾ ਮਤਲਬ ਵੀ ਥੋੜ੍ਹਾ ਜਿਹਾ ਘੱਟ ਹੋਇਆ ਹੋਇਆ ਹੈ ਨਾ ਹਾਂ ਮਤਲਬ ਵੀ ਇਹਦੇ 'ਚ ਪਤਾ ਕੀ ਗੱਲ ਹੈ ਉਹੀ ਹੈ ਵੀ ਜਿਹੜੇ ਮੈਂ ਤਾਂ ਇਹੀ ਮਤਲਬ ਕਹੂੰਗਾ ਮੈਂ ਤੁਹਾਡੇ ਨਾਲ ਸਿਰਫ ਇਹੀ ਅ ਕਰਨਾ ਚਾਹੁੰਦਾ ਸੀਗਾ ਡਿਸਕਸ ਇਸ ਟੋਪਿਕ 'ਤੇ ਹੀ ਵੀ ਜਿਹੜੇ ਸਰਕਾਰੀ ਸਕੂਲ ਉਹ ਬੈਸਟ ਨੇ ਹਰ ਪੱਖੋਂ ਬੈਸਟ ਨੇ ਉਹਨਾਂ ਦੀ ਬਿਲਡਿੰਗ ਉਹਨਾਂ ਦੀ ਬਿਲਡਿੰਗ ਬੜੀ ਵਧੀਆ ਬਾਕੀ ਉਹਨਾਂ ਦਾ ਫਰਨੀਚਰ ਵਗੈਰਾ ਸਾਰਾ ਓਕੇ ਹੈ ਪਲਸ ਉਹਨਾਂ ਦੇ ਜਿਹੜੇ ਮਿਡਡੇ ਮੀਲ ਹੋ ਗਿਆ ਦੇਖੋ ਜੀ ਇਹਦਾ ਆਪਾਂ ਪਹਿਲਾਂ ਵੀ ਆਪਾਂ ਰਿਪੀਟ ਕੀਤਾ ਮੈਂ ਤੁਹਾਨੂੰ ਮਿਡਡੇ ਮੀਲ ਹੋ ਗਿਆ ਟੀਚਰ ਅੱਛੇ ਹੋ ਗਏ ਸਾਰੇ ਟੀਚਰ ਪੂਰੇ ਹੋ ਗਏ ਬੱਚੇ ਮਤਲਬ ਵਧੀਆ ਅਨੁਸ਼ਾਸਨੀ ਬੱਚੇ ਪੈਦਾ ਹੋ ਰਹੇ ਇੱਥੋਂ ਬੱਚੇ ਮਤਲਬ ਤਾਲੀਮ ਲੈ ਕੇ ਵਧੀਆ ਮਤਲਬ ਬੱਚੇ ਜਾ ਰਹੇ ਹੈਗੇ ਗੇਮਾਂ 'ਚ ਵੀ ਜਾ ਰਹੇ ਨੇ ਅਤੇ ਇਸ ਕਰਕੇ ਵਧੀਆ ਸਰ ਚੱਲੋ ਸਕੂਲ ਅੱਛੇ ਰਹਿਣਗੇ ਤਾਂ ਉਹਦੇ 'ਚੋਂ ਮਤਲਬ ਬੱਚੇ ਵਧੀਆ ਚਲੇ ਜਾਣਗੇ ਹੈ ਨਾ ਬਿਲਕੁਲ ਹਾਂਜੀ ਹਾਂਜੀ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਵੈਸੇ ਅੱਜ ਕੱਲ੍ਹ ਲੁੱਟ ਹੀ ਹੈ ਮੈਂ ਤਾਂ ਇਹੀ ਕਹੂੰਗਾ ਜੀ ਹਾਂਜੀ ਹਾਂਜੀ ਤੋ ਸਰਕਾਰੀ ਅੱਛੀ ਗੱਲ ਹੈ ਜੀ ਵਧੀਆ ਮਤਲਬ ਮੈਂ ਤਾਂ ਕਹਿੰਦਾ ਸਰਕਾਰ ਨੂੰ ਆਪਾਂ ਨੂੰ ਉਹ ਕਰਨਾ ਚਾਹੀਦਾ ਅੱਛੀ ਗੱਲ ਹੈ ਸਰ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਮੈਂ ਤਾਂ ਇਹੀ ਤੁਹਾਡੇ ਨਾਲ ਇਸੇ ਟੋਪਿਕ 'ਤੇ ਡਿਸਕਸ ਕਰਨੀ ਸੀ ਸਰ ਧੰਨਵਾਦ ਤੁਹਾਡਾ ਸਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਫਿਰ